ਮੈਂ ਅਕਸਰ ਤਾਂ ਟੀ ਵੀ ਨਹੀਂ ਦੇਖਦੀ ਪਰ ਇੱਕ ਸ਼ੋਅ ਜੋ ਕਿ ਮੇਰਾ ਮਨ ਪਸੰਦੀਦਾ ਹੈ ਅਤੇ ਜਿਸ ਨੂੰ ਮੈਂ ਕਦੇ ਵੀ ਮਿਸ ਨਹੀਂ ਕਰਨਾ ਚਾਹੁੰਦੀ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਦੇਖਣ ਲਈ ਸਮਾਂ ਕੱਢ ਹੀ ਲੈਦੀ ਹਾਂ ਅਤੇ ਜਦੋਂ ਵੀ ਕੰਮਾਂ ਕਾਰਾਂ 'ਚ ਵਿਅਸਤ ਹੋਣ ਕਾਰਨ ਮੈਂ ਇਸਨੂੰ ਮਿਸ ਕਰ ਦਿੰਦੀ ਹਾਂ ਤਾਂ ਮੈਂ ਇਸਨੂੰ ਹੋਟਸਟਾਰ ਤੋਂ ਦੇਖ ਲੈਦੀ ਹਾਂ ਇਸ ਦਾ ਇਸ ਸ਼ੋਅ ਦਾ ਨਾਮ ਹੈ ਯੇੇ ਹੈ ਮੁਹੱਬਤੇ ਇਹ ਸ਼ੋਅ ਮੇਰਾ ਫੇਵਰਟ ਸ਼ੋਅ ਹੈ ਕਿਉਂਕਿ ਇਸ ਵਿੱਚ ਮੇਰੀ ਪਸੰਦੀਦਾ ਮਾਡਲ ਹੈ ਜਿਸਦਾ ਨਾਮ ਇਸ਼ਿਤਾ ਹੈ ਅਤੇ ਜੋ ਅ ਇਹ ਪਸੰ ਇਹ ਸ਼ੋਅ ਮੈਂ ਇਹ ਸ਼ੋਅ ਮੇਰਾ ਪਸੰਦੀਦਾ ਹੈ ਕਿਉਂਕਿ ਇਸ ਵਿੱਚ ਇੱਕ ਛੋਟੀ ਜਿਹੀ ਕੁੜੀ ਹੈ ਜੋ ਕਿ ਆਪਣੀ ਮਤਰੇਈ ਮਾਂ ਨਾਲ ਰਹਿੰਦੀ ਹੈ ਅਤੇ ਇਸ਼ਿਤਾ ਉਸਨੂੰ ਬਹੁਤ ਹੀ ਪਿਆਰ ਨਾਲ ਰੱਖਦੀ ਹੈ ਭਾਵੇਂ ਕਿ ਉਹ ਉਸਦੀ ਬੇਟੀ ਨਹੀਂ ਹੈ ਅਤੇ ਉਸਨੂੰ ਉਸਦੇ ਆਉਣ ਵਾਲੇ ਭਵਿੱਖ ਲਈ ਇੱਕ ਅਜਿਹੇ ਤਰੀਕੇ ਨਾਲ ਤਿਆਰ ਕਰਦੀ ਹੈ ਤਾਂ ਕਿ ਉਹ ਆਉਣ ਵਾਲੀ ਕਿਸੇ ਵੀ ਮੁਸੀਬਤ ਦੇ ਨਾਲ ਨਿਪਟ ਸਕੇ